ਯੋਗਾ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਅਹਿਮ ਸਥਾਨ ਹੈ ਜੋ ਯੋਗ ਕਰਨ ਨਾਲ ਸਰੀਰ ਤਾਂ ਠੀਕ ਰਹਿੰਦਾ ਹੈ ਮਾਨਸਿਕ ਪੱਖੋਂ ਵੀ ਤੁਸੀਂ ਬੜਾ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਦੇ ਹੋ ਯੋਗਾ ਕਰਨ ਦੇ ਫਾਇਦੇ ਬਹੁਤ ਹਨ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਨਾ ਸਫਲ ਬਣਨਾ ਚਾਹੁੰਦੇ ਹੋ ਆਪਣੀ ਸਰੀਰ ਨੂੰ ਤਰੋ ਤਾਜ਼ਾ ਰੱਖਣਾ ਚਾਹੁੰਦੇ ਹੋ ਆਪਣੀ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਯੋਗਾ ਜ਼ਰੂਰ ਕਰਨੀ ਚਾਹੀਦੀ ਹੈ ਮੈਂ ਵੀ ਇਸ ਤਰ੍ਹਾਂ ਦਾ ਆਪਣਾ ਇੱਕ ਅਨੁਭਵ ਕਰਨਾ ਚਾਹਵਾਂਗੀ ਤੁਹਾਡੇ ਨਾਲ ਪੇਸ਼ ਕਰਨਾ ਚਾਹਵਾਂਗੀ ਜਿਹਦੇ ਵਿੱਚ ਮੇਰਾ ਜਦੋਂ ਸਰੀਰ ਠੀਕ ਨਹੀਂ ਸੀ ਰਹਿੰਦਾ ਮੇਰੇ ਸਾਰੇ ਸਰੀਰ ਦੇ ਵਿੱਚ ਦਰਦਾਂ ਨਿਕਲਦੀਆਂ ਸਨ ਅਤੇ ਇਹਨਾਂ ਦਰਦਾਂ ਦੇ ਕਰਕੇ ਮੈਂ ਮਾਨਸਿਕ ਪੱਖੋਂ ਵੀ ਬੜੀ ਦੁਖੀ ਹੋ ਚੁੱਕੀ ਸੀ ਇਸ ਕਰਕੇ ਮੈਂ ਯੋਗਾ ਦੀ ਕਲਾਸ ਜੁਆਇਨ ਕਲਾਸਾਂ ਜੁਆਇਨ ਕੀਤੀਆਂ ਉਹਦੇ ਵਿੱਚ ਮੈਂ ਆਪਣੇ ਯੋਗਾ ਯੋਗਾ ਦੇ ਨਾਲ ਘਰ ਵਿੱਚ ਹੀ ਯੋਗਾ ਕਰ ਕਰਕੇ ਮੈਂ ਆਪਣੀ ਸਰੀਰ ਨੂੰ ਠੀਕ ਕੀਤਾ ਇਹ ਯੋਗਾ ਕਰਨ ਦੇ ਨਾਲ ਤਾਂ ਸਰੀਰ ਦੇ ਦਰਦ ਤਾਂ ਠੀਕ ਹੋ ਗਏ ਨਾਲ ਮੈਂ ਮਾਨਸਿਕ ਪੱਖੋਂ ਵੀ ਬਹੁਤ ਵਧੀਆ ਫੀਲ ਮਾਨਸਿਕ ਪੱਖੋਂ ਵੀ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ ਯੋਗਾ ਦੇ ਵਿੱਚ ਇੱਕ ਆਸਣ ਹੈਗਾ ਬਟਰਫਲਾਈ ਇਹਦੇ ਵਿੱਚ ਬਟਰ ਫਲਾਈ ਹੈਗਾ ਸ਼ੀਸ਼ ਆਸਣ ਹੈਗਾ ਅਤੇ ਲੋਮ ਵਿਲੋਮ ਹੈਗਾ ਆਸਣ ਇਹ ਇਹਨਾ ਆਸਣਾਂ ਦੇ ਕਰਨ ਨਾਲ ਲੇਡੀਜ ਨੂੰ ਬੜਾ ਫਾਇਦਾ ਮਿਲਦਾ ਹੈ ਉਹਨਾਂ ਦੀਆਂ ਅੰਦਰੂਨੀ ਕਈ ਜ਼ਿਆਦਾ ਪ੍ਰੋਬਲਮ ਦੂਰ ਹੋ ਜਾਂਦੀਆਂ ਹਨ ਇਸ ਕਰਕੇ ਯੋਗ ਕਰਨ ਦੇ ਫਾਇਦੇ ਬਹੁਤ ਹਨ ਯੋਗਾ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੁਸੀਂ ਮਾਨਸਿਕ ਪੱਖੋਂ ਵੀ ਬਹੁਤ ਜ਼ਿਆਦਾ ਆਪਣੇ ਘਰ ਦੇ ਵਿੱਚ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਦੇ ਹੋ ਤੁਸੀਂ ਫਿਟ ਰਹਿੰਦੇ ਹੋ ਤੁਹਾਡੀ ਉਮਰ ਵੀ ਜ਼ਿਆਦਾ ਨਹੀਂ ਲੱਗਦੀ ਅਤੇ ਤੁਸੀਂ ਆਪਣੇ ਆਪ ਨੂੰ ਸੋਹਣਾ ਅਤੇ ਸੁਚੱਜਾ ਮਹਿਸੂਸ ਕਰਦੇ ਹੋ ਯੋਗ ਕਰਨ ਨਾਲ ਸਰੀਰ ਦੇ ਵਿੱਚ ਤੰਦਰੁਸਤੀ ਆਉਂਦੀ ਹੈ ਅਤੇ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਇਸ ਕਰਕੇ ਮੈਂ ਤਾਂ ਯੋਗ ਕਰਨ ਨੂੰ ਬਹੁਤ ਜ਼ਿਆਦਾ ਵਧੀਆ ਯੋਗ ਕਰਨਾ ਬਹੁਤ ਜ਼ਿਆਦਾ ਵਧੀਆ ਕਰਾਂਗੀ ਕਿ ਤੁਸੀਂ ਵੀ ਸਾਰੇ ਲੋਕੀ ਯੋਗ ਕਰੋ